ਫੋਟੋਗ੍ਰਾਫੀ ਦੀ ਗੱਲ ਕਰੀਏ ਜੋ ਕਿ ਮੇਰੀ ਇੱਕ ਹੋਬੀ ਆ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਫੋਟੋਗ੍ਰਾਫੀ ਕਰਨਾ ਜਾਂ ਫੋਟੋਜ਼ ਕਲਿੱਕ ਕਰਵਾਉਣਾ ਅਤੇ ਜੇ ਪੁਰਾਣੇ ਜ਼ਮਾਨੇ ਦੀ ਜਾਂ ਹੁਣ ਦੇ ਜ਼ਮਾਨੇ ਦੀ ਦੋਨਾਂ ਨੂੰ ਕੰਪੈਰੀਜ਼ਨ ਕਰਕੇ ਗੱਲ ਕਰੀਏ ਅਤੇ ਪਹਿਲੇ 'ਚ ਜਿਹੜੇ ਕੈਮਰੇ ਸੀਗੇ ਉਹਨਾਂ ਦੇ ਵਿੱਚ ਫੋਟੋ ਨੂੰ ਪਹਿਲਾਂ ਪੂਰਾ ਫੋਕੱਸ ਕਰਨਾ ਪੈਂਦਾ ਸੀ ਜਾਂ ਫੋਟੋ ਖਿੱਚਣ ਲਈ ਪਹਿਲਾਂ ਸਾਨੂੰ ਪੂਰੀ ਲਾਈਟ ਚਾਹੀਦੀ ਸੀਗੀ ਅਤੇ ਸਾਡਾ ਮਤਲਬ ਕਿ ਬੈਕਗਰਾਊਂਡ ਵਗੈਰਾ ਜਾਂ ਕੁਛ ਵੀ ਕਹਿ ਲਈਏ ਸਾਰਾ ਕੁਝ ਪ੍ਰੋਪਰ ਕਰਨ ਲਈ ਸਾਨੂੰ ਪੁ ਮਤਲਬ ਕਿ ਟਾਈਮ ਚਾਹੀਦਾ ਹੁੰਦਾ ਸੀ ਅਤੇ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਦੇ ਜ਼ਮਾਨੇ ਵਿੱਚ ਤਾਂ ਹੁਣ ਫੋਟੋਗ੍ਰਾਫੀ ਕਰਨ ਲਈ ਬਹੁਤ ਸਾਰੇ ਕੈਮਰਾ ਫੋਨ ਦੇ ਕੈਮਰੇ ਬਹੁਤ ਹੀ ਵਧੀਆ ਆ ਗਏ ਜਿਹਦਾ ਕਿ ਸਾਨੂੰ ਕੁਛ ਸਮੇਂ ਵਿੱਚ ਕਿ ਆਪਾਂ ਕਿੰਨੀਆਂ ਸ ਫੋਟੋਆਂ ਕਲਿੱਕ ਕਰ ਸਕਦੇ ਹਾਂ ਅਤੇ ਹਰ ਇੱਕ ਟਾਈਮ ਵਿੱਚ ਆਪਾਂ ਵੱਖਰੇ ਵੱਖਰੇ ਸਟਾਈਲ ਜਾਂ ਪੋਜ਼ਿਜ਼ ਵਿੱਚ ਫੋਟੋ ਕਲਿੱਕ ਕਰਵਾ ਸਕਦੇ ਹਾਂ ਅਤੇ ਸਾਨੂੰ ਲਾਈਟ ਦਾ ਵੀ ਕੋਈ ਇਸ਼ੂ ਨਹੀਂ ਹੁੰਦਾ ਏ ਇਸ ਟਾਈਮ ਵਿੱਚ ਕਿਉਂਕਿ ਫੋਨ ਦੇ ਕੈਮਰੇ ਬਹੁਤ ਵਧੀਆ ਆ ਗਏ ਹੈ ਕਿ ਸਾਨੂੰ ਲਾਈਟ ਦਾ ਵੀ ਇੰਨਾਂ ਈਸ਼ੂ ਨਹੀਂ ਹੁੰਦਾ ਅਤੇ ਫੋਟੋ ਪਿਛਲੇ ਜ਼ਮਾਨੇ ਤੋਂ ਇਸ ਦੇ ਜ਼ਮਾਨੇ ਵਿੱਚ ਬਹੁਤ ਜ਼ਿਆਦਾ ਖਿੱਚਣ ਵਿੱਚ ਘੱਟ ਸਮਾਂ ਹੁੰਦਾ ਹੈ ਅਤੇ ਇਸ ਵਿੱਚ ਐਡੀਟਿੰਗ ਵਗੈਰਾ ਤਾਂ ਸ਼ੁਰੂ ਤੋਂ ਹੀ ਵਧੀਆ ਹੋਣ ਮਤਲਬ ਕਿ ਪਹਿਲਾਂ ਦੀ ਜ਼ਮਾਨੇ ਤੋਂ ਇਸ ਦੇ ਜ਼ਮਾਨੇ ਵਿੱਚ ਬਹੁਤ ਜ਼ਿਆਦਾ ਵਧੀਆ ਫੋਟੋਗ੍ਰਾਫੀ ਹੋਣ ਲੱਗ ਪਈ ਆ ਅਤੇ ਕੈਮਰੇ ਵਗੈਰਾ ਵੀ ਵਧੀਆ ਆ ਗਏ ਨੇ